ਹਾਂ ਬਿਲਕੁਲ ਇੱਕ ਖੂਹ ਤੋਂ ਪਾਣੀ ਕੱਢਣ ਲਈ ਆਮ ਤੌਰ 'ਤੇ ਇਲੈਕਟਰੀਕਲ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਖੂਹ ਤੇ ਗਹਿਰਾਈ ਤੀਹ ਤੋਂ ਪੰਜਾਹ ਫੁੱਟ ਹੈ ਤਾਂ ਸੈਂਟਰਫਿਗਲ ਮੋਟਰ ਪੰਪ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਖੂਹ ਦੀ ਗਹਿਰਾਈ ਸੌ ਤੋਂ ਪੰਜ ਸੌ ਫੁੱਟ ਹੈ ਤਾਂ ਸਮਰਸੀਬਲ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਪਾਣੀ ਦੇ ਵਿੱਚ ਇਸਤੇਮਾਲ ਹੁੰਦੀ ਹੈ ਸਮਰਸੀਬਲ ਮੋਟਰ ਖੂਹ ਦੇ ਪਾਣੀ ਵਾਲੇ ਹਿੱਸੇ ਵਿੱਚ ਪਾਈਪ ਰਾਹੀਂ ਪਾਣੀ ਚੁੱਕਦੀ ਹੈ ਸੈਂਟਰੀਫਿਕਲ ਮੋਟਰ ਖੂਹ ਦੇ ਮੂੰਹ 'ਤੇ ਰੱਖੀ ਜਾਂਦੀ ਹੈ ਅਤੇ ਪਾਈਪ ਰਾਹੀਂ ਪਾਣੀ ਚੁੱਕਦੀ ਹੈ ਮੋਟਰ ਨੂੰ ਪਾਣੀ ਤੱਕ ਪਹੁੰਚਾਉਣ ਲਈ ਪੀਬੀਸੀ ਜਾਂ ਜੀਆਈ ਪਾਈਪ ਵਰਤੀ ਜਾਂਦੀ ਹੈ ਮੋਟਰ ਦੀ ਵਰਤੋਂ ਲਈ ਮਜ਼ਬੂਤ ਅਤੇ ਸੁਰੱਖਿਅਤ ਵਾਰਿੰਗ ਲਗਾਈ ਜਾਂਦੀ ਹੈ ਮੋਟਰ ਨੂੰ ਕੰਟਰੋਲ ਪੈਨਲ ਰਾਹੀ ਚਾਲੂ ਕਰਦੇ ਹਾਂ ਮੋਟਰਾਂ 'ਤੇ ਚੱਲਣ ਨਾਲ ਵੈਕਿਊਮ ਤਿਆਰ ਹੁੰਦਾ ਹੈ ਜੋ ਪਾਣੀ ਨੂੰ ਪਾਈਪ ਰਾਹੀਂ ਉੱਪਰ ਖਿੱਚ ਲੈਂਦਾ ਹੈ ਪਾਣੀ ਦੀ ਸਪਲਾਈ ਨੂੰ ਖੇਤ ਖੇਤ ਟੈਂਕ ਤੱਕ ਪਹੁੰਚਾਉਣ ਲਈ ਪਾਈਪ ਰਾਹੀਂ ਵਗਾਇਆ ਜਾਂਦਾ ਹੈ ਕੁਝ ਮੋਟਰਾਂ 'ਚ ਆਟੋਮੈਟਿਕ ਕੱਟ ਆਊਟ ਵੀ ਹੁੰਦਾ ਹੈ ਜੋ ਪਾਣੀ ਖਤਮ ਹੋਣ 'ਤੇ ਮੋਟਰ ਗਰਮ ਹੋਣ ਤੋਂ ਬਚਾਉਣ ਲਈ ਆਪਣੇ ਆਪ ਮੋਟਰ ਬੰਦ ਹੋ ਜਾਂਦੀ ਹੈ ਮੋਟਰ ਚਾਲੂ ਕਰਨ ਤੋਂ ਪਹਿਲਾਂ ਪਾਣੀ ਦੀ ਉਪਲਬਧਤਾ ਯਕੀਨੀ ਬਣਾਈ ਜਾਂਦੀ ਹੈ ਜੇ ਤੁਸੀਂ ਖੂਹ